ਪੰਜਾਬ ਵਿੱਚ ਬਹੁਤ ਸਾਰੀਆਂ ਸੱਭਿਆਚਾਰਕ ਪਰੰਪਰਾਵਾਂ ਅਤੇ ਰੀਤੀ ਰਿਵਾਜ਼ ਹਨ ਪੰਜਾਬ ਦੇ ਵਿੱਚ ਇਹ ਸਾਰੀਆਂ ਸੱਭਿਆਚਾਰ ਜੋ ਵੀ ਰੀਤੀ ਰਿਵਾਜ਼ ਹੈ ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਰਹਿੰਦੇ ਆ ਜਿਵੇਂ ਕਿ ਨਵੇਂ ਅਨਾਜ ਦਾ ਮੱਥਾ ਟੇਕਣਾ ਹੋਰ ਸ਼ੀਤਲਾ ਮਾਤਾ ਦਾ ਜੋ ਮੱਥਾ ਟੇਕਦੇ ਹੈ ਇੱਦਾਂ ਬਹੁਤ ਸਾਰੇ ਮੱਥੇ ਹੈ ਜਿਹੜੇ ਉਹ ਟੇਕੇ ਜਾਂਦੇ ਹੈ ਅਤੇ ਹੋਰ ਬਹੁਤ ਸਾਰੇ ਰੀਤੀ ਰਿਵਾਜ਼ ਜਿਹੜੇ ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਰਹਿੰਦੇ ਹੈ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਸੱਭਿਆਚਾਰਕ ਪਰੰਪਰਾਵਾਂ ਅਤੇ ਰੀਤ ਰੀਤੀ ਰਿਵਾਜ਼ ਜਿਵੇਂ ਕਿ ਜਨਮ ਅਤੇ ਮਰਨ ਸਮੇਂ ਕੁਝ ਰੀਤੀ ਰਿਵਾਜ਼ ਹੁੰਦੇ ਹੈ ਜਨਮ ਦੇ ਸਮੇਂ ਜਨਮ ਤੋਂ ਬਾਅਦ ਬੱਚੇ ਨੂੰ ਗੁੜ੍ਹਤੀ ਦਿੱਤੀ ਜਾਂਦੀ ਹੈ ਅਤੇ ਇਸ ਤਰੀਕੇ ਦੇ ਨਾਲ ਵਿਆਹ ਦੇ ਵਿੱਚ ਕੁਝ ਰੀਤੀ ਰਿਵਾਜ਼ ਹੁੰਦੇ ਹੈ ਜਿਵੇਂ ਕਿ ਜਦੋਂ ਵਿਆਹ ਤੋਂ ਬਾਅਦ ਲਾੜਾ ਘਰ ਆਉਂਦਾ ਹੈ ਤਾਂ ਉਸ ਦੀ ਮਾਂ ਹੈ ਜਿਹੜੀ ਉਹ ਲਾੜਾ ਲਾੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੈ ਇਸ ਤੋਂ ਇਲਾਵਾ ਹੋਰ ਰੀਤੀ ਰਿਵਾਜ਼ ਜਿਵੇਂ ਕਿ ਮਰਨ ਦੇ ਜਦੋਂ ਬੰਦੇ ਦੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਵੈਣ ਪਾਏ ਜਾਂਦੇ ਹਨ ਉਸ ਤੋਂ ਬਾਅਦ ਉਸ ਨੂੰ ਸ਼ਮਸ਼ਾਨਘਾਟ ਦੇ ਵਿੱਚ ਲਿਜਾਇਆ ਜਾਂਦਾ ਹੈ ਅਤੇ ਜੋ ਔਰਤਾਂ ਹਨ ਉਹ ਕੁਛ ਪਿੱਛੇ ਦੂਰੀ 'ਤੇ ਹੀ ਖੜ੍ਹ ਜਾਂਦੀਆਂ ਹਨ ਅਤੇ ਉਹਨਾਂ ਨੂੰ ਅੰਦਰ ਨਹੀਂ ਲੈ ਕੇ ਜਾਇਆ ਜਾਂਦਾ ਇਸ ਤਰ੍ਹਾਂ ਜਦੋਂ ਮੁੜ ਕੇ ਆਉਂਦੇ ਹੈ ਤਾਂ ਉਹ ਇੱਕ ਕੰਡਾ ਤੋੜ ਕੇ ਉਸ ਦੇ ਡੱਕੇ ਤੋੜ ਕੇ ਉਸ ਦੇ ਵਿੱਚ ਸਿੱਟਦੇ ਹਨ ਚਿਤਾ ਚਿਖਾ ਦੇ ਵਿੱਚ ਸੁੱਟਿਆ ਜਾਂਦਾ ਹੈ ਤਾਂ ਕਿ ਉਸ ਦੇ ਨਾਲ ਆਪਣਾ ਰਿਸ਼ਤਾ ਤੋੜ ਦਿੰਦੇ ਹਨ ਅਤੇ ਉਸ ਤੋਂ ਪਸ਼ਚਾਤ ਗੁਰਦੁਆਰੇ ਦੇ ਵਿੱਚ ਜਾਂਦੇ ਹਨ ਗੁਰਦੁਆਰੇ ਦੇ ਵਿੱਚ ਆਪਣਾ ਜੋ ਵੀ ਲੰਗਰ ਛੱਕ ਕੇ ਆਪਣਾ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਰੀਤੀ ਰਿਵਾਜ਼ ਹੈ ਜਿਹੜੇ ਹੋਰ ਉਹ ਪੰਜਾਬ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਰਹਿੰਦੇ ਹੈ ਅਤੇ ਇਹ ਸਾਰੀਆਂ ਪਰੰਪਰਾਵਾਂ ਸਮਾਜ ਦੇ ਵਿੱਚ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਦੀਆਂ